ਹੈਲੋ ਹਾਂਜੀ ਹਾਂਜੀ ਹਾਂਜੀ ਲਾਇਬ੍ਰੇਰੀ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਮਿਹਰਬਾਨੀ ਕੋਈ ਨਹੀਂ ਘਰ ਨੂੰ ਲੈ ਲਓ ਅਸੀਂ ਦਿੰਦੇ ਹਾਂ ਦੇਖੋ ਸਾਡੀ ਲਾਇਬ੍ਰੇਰੀ ਦੇ ਨਾ ਚਾਰਜਿਸ ਕੋਈ ਨਹੀਂ ਹੈਗੇ ਪਰ ਅਸੀਂ ਸਕਿਉਰਿਟੀ ਪੱਖੋਂ ਦ ਪੰਜ ਸੌ ਰੁਪਈਆ ਲੈਂਦੇ ਹਾਂ ਔਰ ਪੰਜ ਸੌ ਰੁਪਏ ਦੇ ਵਿੱਚ ਸਾਲ ਭਰ ਦੇ ਵਿੱਚ ਤੁਸੀਂ ਸਾਡੇ ਕੋਲ ਕਿਤਾਬਾਂ ਲਓਗੇ ਇੱਕ ਕਿਤਾਬ ਲੈਣੀ ਆ ਤਾਂ ਉਹਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਮੋੜਨਾ ਹੁੰਦਾ ਜੇ ਤੁਹਾਡੇ ਕੋਲ ਬਾਈ ਦੀ ਵੇਅ ਕਿਤਾਬ ਗੁੰਮ ਹੋ ਜਾਂਦੀ ਹੈ ਜਾਂ ਤੁਸੀਂ ਛੇ ਮਹੀਨੇ ਵਾਪਸ ਨਹੀਂ ਕਰਦੇ ਫੇਰ ਜਿਹੜੀ ਤੁਹਾਡੀ ਪੰਜ ਸੌ ਰੁਪਏ ਸਕਿਉਰਿਟੀ ਆ ਉਹਦੇ ਵਿੱਚ ਅਸੀਂ ਪੈਸੇ ਕੁਛ ਕੱਟਾਂਗੇ ਵੈਸੇ ਉੱਦਾਂ ਕੋਈ ਚਾਰਜਿਸ ਨਹੀਂ ਹੈਗੇ ਹਾਂ ਜਦੋਂ ਮਰਜ਼ੀ ਆ ਜਾਓ ਤੁਹਾਨੂੰ ਜਿਹੜੀ ਵੀ ਕਿਤਾਬ ਕਹੋਂਗੇ ਉਹ ਲੈ ਲਓ ਹਾਂਜੀ ਹਾਂਜੀ ਜੋ ਸਾਨੂੰ ਕੋ ਉਹਦੀ ਕੋਸਟ ਪਈ ਆ ਉਹਦੇ ਅਸੀਂ ਪੂਰੇ ਪੈਸੇ ਲਵਾਂਗੇ ਤੁਹਾਡੀ ਸਕਿਉਰਿਟੀ 'ਚੋਂ ਕੱਟ ਹੋ ਜਾਣਗੇ ਅਗਰ ਕਿਤਾਬ ਦੀ ਕੀਮਤ ਜ਼ਿਆਦਾ ਸਕਿਉਰਿਟੀ ਤੋਂ ਫਿਰ ਤੁਹਾਡੇ ਕੋਲ ਅਸੀਂ ਉਹ ਚਾਰਜ ਕਰਾਂਗੇ ਨਹੀਂ ਨਹੀਂ ਨਹੀਂ ਤੁਹਾਡੀ ਆਈ ਡੀ ਬਣਾਵਾਂਗੇ ਆਈ ਡੀ ਦੇ ਜਦੋਂ ਬਣਾਉਣੀ ਉਹਦੇ ਵਿੱਚ ਆਧਾਰ ਕਾਰਡ ਤਾਂ ਲੈਣਾ ਹੀ ਆ ਹਾਂਜੀ ਚਲੋ ਬਾਕੀ ਬੈਠ ਕੇ ਗੱਲ ਕਰਾਂਗੇ ਜੀ